ਹੈਲੋ ਤੁਸੀਂ ਓਲਾ ਤੋਂ ਬੋਲਦੇ ਜੀ ਅਸੀਂ ਨਾ ਪੰਦਰਾਂ ਤਰੀਕ ਨੂੰ ਜਾਣਾ ਹੀ ਚਾਹੁੰਦੇ ਘੁੰਮਣ ਅਨੰਦਪੁਰ ਸਾਹਿਬ ਵਾਲੀ ਸਾਈਡ 'ਤੇ ਦਸ ਜਣੇ ਹਾਂ ਅਤੇ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਵੀ ਤੁਹਾਡੇ ਕੋਲ ਗੱਡੀਆਂ ਨੀਆ ਵਾ ਕਾਰਾਂ ਕਿਹੜੀਆਂ ਕਿਹੜੀਆਂ ਕਿਸਮ ਦੀਆਂ ਕਾਰਾਂ ਵਾ ਅਤੇ ਕਿੰਨੀਆਂ ਸਾਨੂੰ ਹਾਇਰ ਕਰਨੀਆਂ ਪੈਣਗੀਆਂ ਚੰਗੀਆਂ ਗੱਡੀਆਂ ਦਸ ਸਵਾਰੀਆਂ ਵਾਸਤੇ ਅਸੀਂ ਤਿੰਨ ਦਿਨ ਦਾ ਪ੍ਰੋਗਰਾਮ ਬਣਾਉਣਾ ਵਾਂ ਅਤੇ ਤਿੰਨ ਦਿਨ ਅਸੀਂ ਵੱਖ ਵੱਖ ਥਾਵਾਂ 'ਤੇ ਘੁੰਮਦੇ ਹੋਏ ਜਾਣਾ ਵਾਂ ਅਤੇ ਜਿਹਦੇ ਵਿੱਚ ਸਾਡਾ ਸਮਾਨ ਜਿਹੜਾ ਉਹ ਵੀ ਸੇਫ ਰਹੇ ਅਤੇ ਵਧੀਆ ਤਰੀਕੇ ਨਾਲ ਰਹੇ ਰਾਹ ਦੇ ਵਿੱਚ ਕੋਈ ਬਾਰਸ਼ ਵਗੈਰਾ ਦੇ ਨਾਲ ਭਿੱਜੇ ਵੀ ਨਾ ਜਿਹੜਾ ਜਾਣ ਆਉਣ ਦਾ ਕਿਰਾਇਆ ਵਾ ਉਹ ਵੀ ਸਾਨੂੰ ਪਤਾ ਲੱਗ ਜੇ ਕਿੰਨਾ ਵੀ ਅਤੇ ਜਿਹੜੇ ਤੁਹਾਡੇ ਡਰਾਈਵਰ ਆ ਉਹ ਕਿਸ ਕਿਸਮ ਦੇ ਆ ਸਾਨੂੰ ਕੋਈ ਵਧੀਆ ਡਰਾਈਵਰ ਚਾਹੀਦੇ ਆ ਅਤੇ ਨਾਲ ਹੀ ਜਿਹੜੇ ਆ ਉਹ ਚੰਗੀਆਂ ਗੱਡੀਆਂ ਚਾਹੀਦੀਆਂ ਜਿਨ੍ਹਾਂ ਦੇ ਟਾਇਰ ਵੀ ਚੰਗੇ ਹੋਣ ਸੀਟਾਂ ਵਗੈਰਾ ਵੀ ਚੰਗੀਆਂ ਹੋਣ ਫਟੀਆਂ ਨਾ ਹੋਣ ਜਿਹੜੇ ਜਾਣ ਆਉਣ ਦਾ ਪੂਰਾ ਪ੍ਰਬੰਧ ਆ ਨਾ ਉਹ ਤੁਹਾਡੀ ਜ਼ਿੰਮੇਵਾਰ ਵਾਲਾ ਬੰਦਾ ਚਾਹੀਦਾ ਸਾਨੂੰ ਅਤੇ ਜਿਹੜਾ ਕਿਰਾਇਆ ਉਹ ਵੀ ਸਾਨੂੰ ਦੱਸਿਆ ਜਾਵੇ ਵੀ ਕਿੰਨਾ ਕੀ ਤੁਸੀਂ ਲਉਗੇ ਅਤੇ ਗੱਡੀ ਦੀਆਂ ਕਿਸਮਾਂ ਵੀ ਦੱਸੀਆਂ ਜਾਣ ਵੀ ਕਿਹੜੀ ਕਿਹੜੀ ਗੱਡੀ ਤੁਹਾਡੇ ਕੋਲ ਕਿਹੜੀ ਕਿਹੜੀ ਕੰਪਨੀ ਦੀ ਆ ਤਾਂ ਜੋ ਅਸੀਂ ਆਸਾਨ ਨਾਲ ਜਾ ਸਕੀਏ ਅਤੇ ਆ ਸਕੀਏ